ਤਕਨਾਲੋਜੀ ਆਧੁਨਿਕ ਖੇਤੀ ਕਾਰਜਾਂ ਵਿੱਚ ਇੱਕ ਮਹੱਤਵ ਭੂਮਿਕਾ ਨਿਭਾਉਂਦੀ ਹੈ ਪਰੰਪਰਾਗਤ ਖੇਤੀਬਾੜੀ ਅਭਿਆਸਾਂ ਵਿੱਚ ਕ੍ਰਾਂਤੀ ਲਿਆਉਂਦੀ ਹੈ ਅਤੇ ਕੁਸ਼ਲਤਾ ਉਤਪਾਦਕਤਾ ਅਤੇ ਸਥਿਰਤਾ ਨੂੰ ਵਧਾਉਂਦੀ ਹੈ ਕੁਝ ਤਰੀਕਿਆਂ ਨਾਲ ਤਕਨੋਲੋਜੀ ਨੇ ਖੇਤੀ ਕਾਰਜਾਂ ਨੂੰ ਪ੍ਰਭਾਵਿਤ ਕੀਤਾ ਹੈ ਸ਼ੁੱਧਤਾ ਖੇਤੀ ਸ਼ੁੱਧ ਖੇਤੀ ਤਕਨੀਕਾਂ ਜਿਵੇਂ ਕਿ ਜੀ ਪੀ ਐੱਸ ਵੈਲਡ ਟਰੈਕਟਰ ਡਰੋਨ ਅਤੇ ਸੈਂਸਰ ਕਿਸਾਨਾਂ ਨੂੰ ਸਰੋਤ ਪ੍ਰਬੰਧਨ ਨੂੰ ਅਨੁਕੂਲ ਬਣਾਉਣ ਫ਼ਸਲਾਂ ਦੀ ਸਿਹਤ ਦੀ ਨਿਗਰਾਨੀ ਕਰਨਾ ਅਤੇ ਇਨਪੁੱਟਸ ਜਿਵੇਂ ਕਿ ਪਾਣੀ ਖਾਦਾਂ ਅਤੇ ਕੀਟਨਾਸ਼ਕਾਂ ਨੂੰ ਵਧੇਰੇ ਸਟੀਕਤਾ ਨਾਲ ਲਾਗੂ ਕਰਨ ਦੇ ਯੋਗ ਬਣਾਉਂਦੇ ਹਨ ਰਹਿੰਦ ਖੂੰਦ ਅਤੇ ਵਾਤਾਵਰਨ ਨੂੰ ਘੱਟ ਕਰਦੇ ਹਨ ਅਸਰ ਵਰਟੀਕਲ ਫਾਰਮਿੰਗ ਵਰਟੀਕਲ ਫਾਰਮਿੰਗ ਤਕਨੋਲੋਜੀ ਲੰਬਕਾਰੀ ਸਟੈਕਡ ਨਹਿਰਾਂ ਦੇ ਲੰਬਕਾਰੀ ਝੁਕੀ ਹੋਈ ਸੜਾ ਵਿੱਚ ਸਤਾ ਵਿੱਚ ਫ਼ਸਲਾਂ ਦੀ ਕਾਸ਼ਤ ਕਰਨ ਲਈ ਇਜਾਜ਼ਤ ਦਿੰਦੀ ਹੈ ਅਕਸਰ ਘਰ ਦੇ ਅੰਦਰ ਜਾਂ ਨਿਯੰਤਰਿਤ ਵਾਤਾਵਰਣ ਵਿੱਚ ਵਰਟੀਕਲ ਫਾਰਮਿੰਗ ਜਮੀਨ ਦੀ ਵਰਤੋਂ ਦੀ ਕੁਸ਼ਲਤਾ ਨੂੰ ਵੱਧ ਤੋਂ ਵੱਧ ਕਰਦੀ ਹੈ ਪਾਣੀ ਦੀ ਬੱਚਤ ਕਰਦੀ ਹੈ ਅਤੇ ਸ਼ਹਿਰੀ ਖੇਤਰਾਂ ਵਿੱਚ ਤਾਜ਼ੀ ਉਫ਼ ਅਤੇ ਸਾਲ ਭਰ ਦੇ ਉਤਪਾਦਨ ਨੂੰ ਸਮਰੱਥ ਬਣਾਉਂਦੀ ਹੈ ਇਸ ਨਾਲ ਰਵਾਇਤੀ ਖੇਤ ਅਤੇ ਆਵਾਜਾਈ 'ਤੇ ਨਿਰਭ ਨਿਰਭਰਤਾ ਘੱਟਦੀ ਹੈ ਆਟੋਮੇਸ਼ਨ ਅਤੇ ਰੋਬੋਟਿਕਸ ਖੇਤੀਬਾੜੀ ਰੋਬੋਟ ਅਤੇ ਆਟੋਮੈਟਿਡ ਸਿਸਟਮ ਵੱਖ ਵੱਖ ਕੰਮਾਂ ਨੂੰ ਸਚਾਰੂ ਬਣਾਉਂਦੇ ਹਨ ਜਿਵੇਂ ਕਿ ਲਾਉਣਾ ਵਾਢੀ ਨਦੀਨਨਾਸ਼ਕ ਅਤੇ ਨਿਗਰਾਨੀ ਹੱਥੀਂ ਗਿਰਫਤ ਦੀ ਲੋੜ ਨੂੰ ਘਟਾਉਂਦੇ ਹੋਏ ਲੇ ਅਤੇ ਲੇਬਰ ਸਹਿਤ ਪ੍ਰਕਿਰਿਆਵਾਂ ਆਟੋਮੇਸ਼ਨ ਕੁਸ਼ਲਤਾ ਵਿੱਚ ਸੁਧਾਰ ਕਰਦੀ ਹੈ ਲੇਬਰ ਦੀਆਂ ਲਾਗਤਾਂ ਨੂੰ ਘਟਾਉਂਦੀ ਹੈ ਅਤੇ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਦੀ ਹੈ ਖ਼ਾਸ ਤੌਰ ਉੱਤੇ ਦਿਹਾੜੀਦਾਰ ਮਜ਼ਦੂਰਾਂ ਦੀ ਉਪਲਬਧਤਾ ਅਤੇ ਸਮਰੱਥਾ ਨਾਲ ਚੁਣੌਤੀ ਦਾ ਸਾਹਮਣਾ ਕਰ ਰਹੇ ਖੇਤਰਾਂ ਵਿੱਚ ਡੇਟਾ ਵਿਸ਼ਲੇਸ਼ਣ ਅਤੇ ਫੈਸਲਾ ਸਮਰਥਨ ਐਡਵਾਂਸ ਡੇਟਾ ਵਿਸ਼ਲੇਸ਼ਣ ਮਸ਼ੀਨ ਸਿਖਲਾਈ ਅਤੇ ਭਵਿੱਖਬਾਣੀ ਮਾਡਲਿੰਗ ਟੂਲ ਕਿਸਾਨਾਂ ਨੂੰ ਕਾਰਵਾਈ ਯੋਗ ਸੂਝ ਅਤੇ ਫੈਸਲੇ ਸਹਾਇਤਾ ਪ੍ਰਦਾਨ ਕਰਨ ਲਈ ਸੈਂਸਰਾਂ ਸੈਟੇਲਾਈਟਾਂ ਅਤੇ ਹੋਰ ਸਰੋਤਾਂ ਤੋਂ ਵੱਡੀ ਮਾਤਰਾ ਵਿੱਚ ਡੇਟਾ ਦਾ ਵਿਸ਼ਲੇਸ਼ਣ ਕਰਦੇ ਹਨ ਕਿਸਾਨ ਫ਼ਸਲ ਪ੍ਰਬੰਧਨ ਅਭਿਆਸਾਂ ਨੂੰ ਅਨੁਕੂਲਿਤ ਕਰ ਸਕਦੇ ਹਨ ਉਹ ਪੁੱਛਦੀ ਭਵਿੱਖਬਾਣੀ ਕਰ ਸਕਦੇ ਹਨ ਅਤੇ ਡੇਟਾ ਸੰਚਾਲਿਤ ਸਿਫਾਰਿਸ਼ਾਂ ਦੇ ਆਧਾਰ ਅਤੇ ਜੋਖ਼ਮਾਂ ਨੂੰ ਘਟਾ ਸਕਦੇ ਹਨ ਬਾਇਓ ਟੈਕਨੋਲੋਜੀ ਅਤੇ ਜੈਨੇਟਿਕ ਇੰਜੀਨੀਅਰਿੰਗ ਬਾਇਓ ਟੈਕਨੋਲੋਜੀ ਅਤੇ ਜੈਨੀਟਿਕ ਇੰਜੀਨੀਅਰਿੰਗ ਤਕਨੀਕਾਂ ਜਿਵੇਂ ਕਿ ਜੈਨਟਿਕ ਤੌਰ 'ਤੇ ਸੋਧੀਆਂ ਫ਼ਸਲਾਂ ਕੀਟ ਪ੍ਰਤੀਰੋਧ ਸੋਕੇ ਸਹਿਣਸ਼ੀਲਤਾਂ ਅਤੇ ਵਧੀ ਹੋਈ ਪੈਦਾਵਾਰ ਦੀ ਸੰਭਾਵਨਾ ਵਰਗੇ ਫਾਇਦੇਮੰਦ ਗੁਣਾਂ ਵਾਲੀਆਂ ਫ਼ਸਲਾਂ ਦੇ ਵਿਕਾਸ ਨੂੰ ਸਮਰੱਥ ਬਣਾਉਂਦੀਆਂ ਹਨ ਬਾਇਓ ਟੈਕਨੋਲੋਜੀ ਫ਼ਸਲਾਂ ਦੀ ਲਚਕਤਾਂ ਨੂੰ ਵਧਾਉਂਦੀ ਹੈ ਰਸਾਇਣਿਕ ਨਿਵੇਸ਼ਾਂ 'ਤੇ ਨਿਰਭਰਤਾ ਨੂੰ ਘਟਾਉਂਦੀ ਹੈ ਅਤੇ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਕਰਦੀ ਹੈ ਹਾਲਾਂਕਿ ਟੈਕਨਾਲੋਜੀ ਕਿਸਾਨਾਂ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਦੀ ਹੈ ਇਹ ਖੇਤੀਬਾੜੀ ਵਿੱਚ ਦਿਹਾੜੀਦਾਰ ਮਜ਼ਦੂਰਾਂ ਲਈ ਵੀ ਪ੍ਰਭਾਵ ਪਾ ਸਕਦੀ ਹੈ ਬਦਲ ਖੇਤੀ ਵਿੱਚ ਆਟੋਮਿਸ਼ਨ ਅਤੇ ਰੋਬੋਟਿਕਸ ਹੱਥੀਂ ਕਿਰਤ ਨੂੰ ਤਕਨੋਲੋਜੀ ਦੇ ਨਾਲ ਬਦਲ ਸਕਦੇ ਹਨ ਜਿਸ ਨਾਲ ਬਿਜਾਈ ਵਾਢੀ ਅਤੇ ਖੇਤ ਦੀ ਸਾਂਭ ਸੰਭਾਲ ਵਰਗੇ ਕੰਮਾਂ ਲਈ ਦਿਹਾੜੀਦਾਰ ਮਜ਼ਦੂਰਾਂ ਦੀ ਮੰਗ ਘੱਟ ਜਾਂਦੀ ਹੈ ਰੁਜ਼ਗਾਰ ਦੇ ਪੈਟਰਨ ਵਿੱਚ ਤਬਦੀਲੀਆਂ ਖੇਤੀ ਦੇ ਅਵਧਿਆ ਅਭਿਆਸਾਂ ਵਿੱਚ ਤਕਨੋਲੋਜੀ ਦੁਆਰਾ ਸੰਚਾਲਿਤ ਤਬਦੀਲੀਆਂ ਦੇ ਨਤੀਜੇ ਵਜੋਂ ਖੇਤੀਬਾੜੀ ਕਰਮਚਾਰੀਆਂ ਦੇ ਅੰਦਰ ਰੁਜ਼ਗਾਰ ਦੇ ਪੈਟਰਨ ਵਿੱਚ ਬਦਲਾਅ ਹੋ ਸਕਦਾ ਹੈ ਕੁਝ ਦਿਹਾੜੀਦਾਰ ਮਜ਼ਦੂਰ ਉਹਨਾਂ ਭੂਮਿਕਾਵਾਂ ਵਿੱਚ ਤਬਦੀਲ ਹੋ ਸਕਦੇ ਹਨ ਜਿਨ੍ਹਾਂ ਲਈ ਖੇਤੀਬਾੜੀ ਮਸ਼ੀਨਰੀ ਨੂੰ ਚਲਾਉਣ ਅਤੇ ਸਾਂਭ ਸੰਭਾਲ ਕਰਨ ਜਾਂ ਡੇਟਾ ਸੰਚਾਲਿਤ ਖੇਤੀ ਕਾਰਜਾਂ ਦੇ ਪ੍ਰਬੰਧਨ ਵਿੱਚ ਵਿਸ਼ੇਸ਼ ਹੁਨਰ ਦੀ ਲੋੜ ਹੁੰਦੀ ਹੈ